ਸਾਡੇ ਖੇਤਰ ਵਿੱਚ ਬਹੁਤ ਸਾਰੀਆਂ ਮੁੱਖ ਉਪਭਾਸ਼ਾ ਹਨ ਜਿਨ੍ਹਾਂ ਦੇ ਨਾਮ ਇਸ ਪ੍ਰਕਾਰ ਹਨ ਮਾਝਾ ਪੁਆਧੀ ਮੁਲਤਾਨੀ ਮਲਵਈ ਅਤੇ ਹੋਰ ਆਦਿ ਬੋਲੀਆਂ ਜਾਂਦੀਆਂ ਹਨ ਲੋਕ ਸਿੱਖਿਆ ਦੇ ਉਦੇਸ਼ ਲਈ ਹੋਰ ਭਾਸ਼ਾਵਾਂ ਵੀ ਸਿੱਖਦੇ ਹਨ ਜੋ ਕਿ ਮਾੜੀ ਗੱਲ ਨਹੀਂ ਹੈ ਪਰ ਸਾਨੂੰ ਆਪਣੀ ਮਾਂ ਬਲ ਮਾਂ ਬੋਲੀ ਨੂੰ ਵੀ ਚੰਗੀ ਤਰ੍ਹਾਂ ਸਿੱਖਣਾ ਚਾਹੀਦਾ ਹੈ ਅਤੇ ਉਹਨਾਂ ਨੂੰ ਗੱਲ ਕਰਨ ਵਿੱਚ ਮਹਿਸੂਸ ਮਾਣ ਮਹਿਸੂਸ ਹੋਣਾ ਚਾਹੀਦਾ ਹਨ ਕੁਝ ਲੋਕ ਪੰਜਾਬੀ ਬੋਲਣ ਤੋਂ ਸੰਗਦੇ ਹਨ ਅਤੇ ਅੰਗਰੇਜ਼ੀ ਵੱਲ ਜਿਆਦਾ ਰੁਝਾਨ ਰੱਖਦੇ ਹਨ ਸਾਨੂੰ ਇਹ ਠੀਕ ਹੈ ਕਿ ਸਿੱਖਆ ਦੇ ਉਦੇਸ਼ ਲਈ ਹੋਰ ਭਾਸ਼ਾਵਾਂ ਵੀ ਅਸੀਂ ਸਿੱਖ ਸਕਦੇ ਹਾਂ ਅਤੇ ਸਾਨੂੰ ਸਿੱਖਣੀਆਂ ਚਾਹੀਦੀਆਂ ਜਿਸ ਨਾਲ ਸਾਡਾ ਮਾਇੰਡ ਬਹੁਤ ਸਾਰਾ ਡਿਵੈਲਪ ਹੁੰਦਾ ਹੈ ਅਤੇ ਸਾਨੂੰ ਅਲੱਗ ਅਲੱਗ ਇਲਾਕਿਆਂ ਵਿੱਚ ਆਸਾਨੀ ਆਉਂਦੀ ਹੈ ਕਿ ਅਸੀਂ ਹੋਰ ਭਾਸ਼ਾਵਾਂ ਵੀ ਸਿੱਖ ਸਕਦੇ ਹਨ ਪਰ ਸਾਨੂੰ ਆਪਣੀ ਮਾਂ ਮਾਤ ਭਾਸ਼ਾ ਨੂੰ ਨਹੀਂ ਭੁੱਲਣਾ ਚਾਹੀਦਾ ਸਾਨੂੰ ਆਪਣੀ ਮਾਂ ਬੋਲੀ ਵਿੱਚ ਗੱਲ ਕਰਨ ਲਈ ਮਹਿਸੂਸ ਹੋਣਾ ਚਾਹੀਦਾ ਹੈ ਇਸ ਵਿੱਚ ਮਾਂ ਬੋਲੀ ਅ ਸਾਡੀ ਅਜਿਹੀ ਭਾਸ਼ਾ ਹੈ ਜਿਸ ਨੂੰ ਅਸੀਂ ਬਚਪਨ ਤੋਂ ਹੀ ਬੋਲਣ ਲੱਗ ਜਾਂਦੇ ਹਨ ਜਿਸ ਨੂੰ ਅਸੀਂ ਬਚਪਨ ਤੋਂ ਹੀ ਤੋਤਲੇ ਆਵਾਜ਼ ਵਿੱਚ ਬੋਲਦੇ ਹਾਂ ਸਭ ਤੋਂ ਭਾਸ਼ਾ ਪ ਪਹਿਲੀ ਭਾਸ਼ਾ ਅਸੀਂ ਸਿੱਖਦੇ ਹਾਂ ਉਹ ਮਾਂ ਬੋਲੀ ਹੁੰਦੀ ਹੈ ਤੇ ਅਤੇ ਅਸੀਂ ਹੋਰ ਬਾਅਦ ਵਿੱਚ ਅਸੀਂ ਅਸੀਂ ਅਨੇਕ ਭਾਸ਼ਾ ਨੂੰ ਸਿੱਖਦੇ ਹਾਂ ਸਾਨੂੰ ਆਪਣੀ ਉਪਭਾਸ਼ਾ ਅਤੇ ਭਸ਼ਾਵਾਂ ਨੂੰ ਭੁੱਲਣਾ ਨਹੀਂ ਚਾਹੀਦਾ ਅਤੇ ਮਾਂ ਬੋਲੀ ਨੂੰ ਤਾਂ ਸਾਨੂੰ ਗੱਲ ਕਰਨ ਵਿੱਚ ਮਹਿਸੂਸ ਹੋਣਾ ਚਾਹੀਦਾ ਹੈ ਸਾਨੂੰ ਆਪਣੀ ਮਾਂ ਬੋਲੀ ਨਾਲ ਸੰਗਨਾਂ ਨਹੀਂ ਚਾਹੀਦਾ ਗੱਲ ਕਰਨ ਲਈ ਸਾਨੂੰ ਆਪਣੀ ਪਹਿਲਾਂ ਪ੍ਰੈਫਰੈਂਸ ਮਾਂ ਬੋਲੀ ਦੀ ਹੀ ਹੋਣੀ ਚਾਹੀਦੀ ਹੈ ਫਿਰ ਬਾਅਦ ਵਿੱਚ ਸਾਡੀਆਂ ਦੂਜੀਆਂ ਭਾਸ਼ਾਵਾਂ ਆ ਜਾਂਦੀਆਂ ਹਨ ਹਾਲਾਂਕਿ ਇਹ ਦੇਖਿਆ ਗਿਆ ਹੈ ਕਿ ਬਹੁਤ ਸਾਰੇ ਲੋਕ ਅੰਗਰੇਜ਼ੀ ਭਾਸ਼ਾਵਾਂ ਵਿੱਚ ਗੱਲ ਕਰਦੇ ਹਨ ਅਤੇ ਉਹ ਅਪਮਾਨ ਮਹਿਸੂਸ ਕਰਦੇ ਹਨ ਪਰ ਅਜਿਹਾ ਗੱਲ ਨਹੀਂ ਹੈ ਕਿ ਸਾਨੂੰ ਆਪਣੀ ਮਾਂ ਬੋਲੀ ਨੂੰ ਵੀ ਉਨਾਂ ਦਰਜਾ ਦੇਣਾ ਚਾਹੀਦਾ ਹੈ ਜਿੰਨੀ ਅੰਗਰੇਜ਼ੀ ਭਾਸ਼ਵਾਂ ਨੂੰ ਦੇਣਾ ਚਾਹੀਦਾ ਹੈ ਮਾਂ ਬੋਲੀ ਇੱਕ ਅਜਿਹੀ ਬੋਲੀ ਹੈ ਜਿਸ ਵਿੱਚ ਅਸੀਂ ਆਪਣੀ ਸਭ ਤੋਂ ਪਹਿਲਾਂ ਮਾਂ ਬੋਲੀ ਹੀ ਸਿਖਦੇ ਹਾਂ ਤੋਤਲੀ ਆਵਾਜ਼ ਵਿੱਚ ਮਾਂ ਬੋਲੀ ਹੀ ਕੱਢਦੇ ਹਾਂ ਇਸ ਲਈ ਸਾਨੂੰ ਆਪਣੀ ਮਾਂ ਬੋਲੀ ਤੋਂ ਕਦੇ ਵੀ ਘਬਰਾਉਣਾ ਨਹੀਂ ਚਾਹੀਦਾ ਜਿਸ ਕਾਰਨ ਸਾਨੂੰ ਵੱਧ ਤੋਂ ਵੱਧ ਸ਼ਰਮ ਮਹਿਸੂਸ ਨਹੀਂ ਕਰਨੀ ਚਾਹੀਦੀ ਸਾਨੂੰ ਆਪਣੀ ਮਾਂ ਬੋਲੀ ਕਰਨ ਤੋਂ ਮਾਂ ਬੋਲੀ ਬੋਲਣ ਤੋਂ ਸਾਨੂੰ ਸ਼ਰਮ ਮਹਿਸੂਸ ਨਹੀਂ ਹੋਣੀ ਚਾਹੀਦੀ ਸਗੋਂ ਮਾਣ ਮਹਿਸੂਸ ਹੋਣਾ ਚਾਹੀਦਾ ਹੈ ਇਸ ਲਈ ਸਾਨੂੰ ਆਪਣੀ ਮਾਂ ਬੋਲੀ ਨੂੰ ਉੱਚ ਦਰਜਾ ਦੇਣਾ ਚਾਹੀਦਾ ਹੈ ਜਿਸ ਨਾਲ ਸਾਨੂੰ ਆਪਣੀ ਮਾਂ ਬੋਲੀ ਇੱਕ ਸੰਗ ਨਾ ਮਹਿਸੂਸ ਲੱਗੇ ਇਸ ਲਈ ਸਾਨੂੰ ਆਪਣੀ ਮਾਂ ਬੋਲੀ ਜ਼ਿਆਦਾ ਤੋਂ ਜ਼ਿਆਦਾ ਪ੍ਰਚੱਲਿਤ ਕਰਨੀ ਚਾਹੀਦੀ ਹੈ ਅਤੇ ਸਾਨੂੰ ਆਪਣੇ ਮਾਂ ਬੋਲੀ ਗੀਤ ਸੁਣਨੇ ਚਾਹੀਦੇ ਹਨ ਅਤੇ ਹੋਰ ਜ਼ਿਆਦਾ ਉਪਰਾਲੇ ਕਰਨੇ ਚਾਹੀਦੇ ਹਨ ਕਿ ਸਾਡੀ ਮਾਂ ਬੋਲੀ ਗਾਇਬ ਨਾ ਹੋ ਜਾਵੇ